ਸਤਿ ਸ਼੍ਰੀ ਅਕਾਲ ਬਾਈ ਜੀ ਸੇਠੀ ਸ਼ੂਜ਼ ਹਾਊਸ ਤੋਂ ਬੋਲਦੇ ਹੋ ਪਿਛਲੇ ਹਫ਼ਤੇ ਮੈਂ ਇੱਕ ਜੁੱਤਾ ਜੋ ਕਿ ਰੀਬੋਕ ਕੰਪਨੀ ਦਾ ਸੀ ਤੁਹਾਡੀ ਕੰਪਨੀ ਤੋਂ ਮੰਗਵਾਇਆ ਸੀ ਜਦੋਂ ਮੈਂ ਉਹ ਪਾਰਸਲ ਨੂੰ ਲੈਣ ਵਾਸਤੇ ਬਾਹਰ ਗਿਆ ਤਾਂ ਉਸਦਾ ਲਿਫ਼ਾਫ਼ਾ ਫਟਿਆ ਹੋਇਆ ਸੀ ਜਦੋਂ ਮੈਂ ਅੰਦਰ ਆ ਕੇ ਉਸਨੂੰ ਖੋਲ੍ਹਿਆ ਤਾਂ ਜੁੱਤਿਆਂ ਦਾ ਰੰਗ ਅਤੇ ਉਸਦਾ ਸਾਈਜ਼ ਵੀ ਬਹੁਤ ਵੱਡਾ ਸੀ ਚਲੋ ਮੈਂ ਪਾ ਲਏ ਬਟ ਉਹ ਤਾਂ ਤਿੰਨ ਚਾਰ ਦਿਨਾਂ ਵਿੱਚ ਹੀ ਫਟ ਗਏ ਜਿਸ ਕਾਰਨ ਮੈਨੂੰ ਬਹੁਤ ਹੀ ਸ਼ਰਮਿੰਦਗੀ ਮਹਿਸੂਸ ਹੋਈ ਅਤੇ ਮੈਂ ਸੋਚਿਆ ਕਿ ਮੇਰੇ ਸਾਰੇ ਪੈਸੇ ਬਰਬਾਦ ਹੋ ਗਏ ਤਾਂ ਜੋ ਕਿ ਮੈਂ ਤੁਹਾਨੂੰ ਉਲਾਂਭਾ ਦੇਣ ਵਾਸਤੇ ਇਹ ਕਾਲ ਕਰ ਰਿਹਾ ਹਾਂ ਕਿਉਂਕਿ ਮੇਰੇ ਪੈਸੇ ਤਾਂ ਬਰਬਾਦ ਹੋਏ ਹੀ ਹੋਏ ਹੈ ਬਟ ਮੇਰਾ ਸਮਾਂ ਵੀ ਬਰਬਾਦ ਹੋਇਆ ਹੈ ਸੋ ਕਿਰਪਾ ਕਰਕੇ ਮੈਨੂੰ ਮੇਰੇ ਪੈਸੇ ਵਾਪਸ ਕੀਤੇ ਜਾਣ ਧੰਨਵਾਦ